ਹਾਂਜੀ ਮੈਂ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਭਗਵਤ ਗੀਤਾ ਅਤੇ ਕੁਰਾਨ ਆਦਿ ਅਤੇ ਇਹਦੇ ਵਿੱਚੋਂ ਮੈਨੂੰ ਬਹੁਤ ਸਾਰੇ ਸਲੋਕ ਬਹੁਤ ਅੱਛੇ ਲੱਗਦੇ ਹਨ ਜੇ ਇੱਕ ਸਲੋਕ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਅ ਪੜ੍ਹਨਾ ਚਾਹੁੰਦਾ ਹਾਂ ਅਤੇ ਜਿਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਉਹ ਸਲੋਕ ਇਸ ਤਰ੍ਹਾਂ ਹੈ ਕਿ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਇਹਦਾ ਮਤਲਬ ਹੈ ਕਿ ਪਵਣ ਗੁਰੂ ਹੈ ਅਤੇ ਪਾਣੀ ਪਿਤਾ ਅਤੇ ਮਾਤਾ ਸਾਡੀ ਧਰਤੀ ਮਾਂ ਹੈ ਅਤੇ ਇਹਦੇ ਤੋਂ ਸਾਫ ਸਾਨੂੰ ਪ ਮਤਲਬ ਪਤਾ ਚੱਲਦਾ ਹੈ ਕਿ ਸਾਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਕਿ ਸਾਨੂੰ ਹਵਾ ਧਰਤੀ ਮਾਤਾ ਅਤੇ ਪਾਣੀ ਨੂੰ ਦੂਸ਼ਿਤ ਨਹੀਂ ਕਰਨਾ ਚਾਹੀਦਾ ਅਤੇ ਇੱਕ ਆਮ ਇਨਸਾਨ ਵਾਈ ਇੱਕ ਸਿੱਧਾ ਅਤੇ ਇੱਕ ਸਾਫ ਇੱਕ ਸੁਨੇਹਾ ਹੈ ਕਿ ਸਾਨੂੰ ਆਪਣੀ ਧਰਤੀ ਅਤੇ ਸਾਡੇ ਹਵਾ ਪਾਣੀ ਅਤੇ ਸਾਫ ਵਾਤਾਵਰਨ ਲਈ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਸਾਨੂੰ ਸ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ ਜਿੰਨਾ ਜਿੰਨਾ ਹੋ ਸਕੇ ਪੇੜ ਪੌਦੇ ਲਗਾਉਣੇ ਚਾਹੀਦੇ ਆ ਪਾਣੀ ਨੂੰ ਇਕੱਤਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਹੈ